ਹੈਲੋ ਹਾਂਜੀ ਹਾਂਜੀ ਅਨੁਸ਼ਕਾ ਜੀ ਕਿਵੇਂ ਹੋ ਮੈਂ ਵੀ ਵਧੀਆ ਵਧੀਆ ਹੋਰ ਸੁਣਾਓ ਘਰ ਸਭ ਠੀਕ ਕਾਰੋਬਾਰ ਵਧੀਆ ਮੈਂ ਵੀ ਵਧੀਆ ਵਧੀਆ ਜੀ ਹੋਰ ਦੱਸੋ ਬੱਚੇ ਸਹੀ ਨੇ ਅੱਛਾ ਅੱਛਾ ਹਾਂਜੀ ਹਾਂਜੀ ਹਾਂਜੀ ਹਾਂਜੀ ਲੈ ਇੰਨਾ ਵੱਡਾ ਹੋ ਗਿਆ ਕਾਕਾ ਆਪਣਾ ਅੱਛਾ ਅੱਛਾ ਹਾਂਜੀ ਹਾਂਜੀ ਦੇਖੋ ਮੇਰਾ ਕਾਕਾ ਤਾਂ ਫਿਰ ਹਲੇ ਉਹ 'ਚ ਪੜ੍ਹਦਾ ਵਾ ਆਪਣੇ ਗਰੀਨਲੈਂਡ 'ਚ ਅਤੇ ਹਾਂਜੀ ਤਾਂ ਅਤੇ ਮੈਂ ਆਪਣੀ ਕੁੜੀ ਵੀ ਸੋਚਿਆ ਸੀਗਾ ਪਰ ਮੈਂ ਤੁਹਾਨੂੰ ਸਹੀ ਗੱਲ ਕਹਾਂ ਗਰੀਨਲੈਂਡ ਨਾ ਵਧੀਆ ਸਕੂਲ ਨਹੀਂ ਲੱਗਿਆ ਮੈਨੂੰ ਅਤੇ ਸ਼ੋਸ਼ੇਬਾਜੀ ਜੀ ਆ ਬਸ ਉੱਥੇ ਪੜਾਉਂਦੇ ਲਿਖਾਉਂਦੇ ਕੁਛ ਨਹੀਂ ਹੈਗੇ ਵਧੀਆ ਬਟ ਬਿਨਾਂ ਮਤਲਬ ਦੇ ਟੀਚਰਾਂ ਸਾਨੂੰ ਫੋਨ ਕਰਦੀਆਂ ਰਹਿਣਗੀਆਂ ਕੁਝ ਨਹੀਂ ਮਤਲਬ ਕੰਮ ਕੁੰਮ ਉਹਨਾਂ ਨੇ ਕਰਨਾ ਨਾ ਕੋਈ ਉਥੇ ਮੈਂ ਦੇਖਿਆ ਬੱਚਿਆਂ ਨੂੰ ਕੋਈ ਸਾਨੂੰ ਖੇਡਾਂ 'ਚ ਲੈ ਕੇ ਜਾਂਦੇ ਵੀ ਪੜ੍ਹਾਈ ਜਾਂਦੇ ਪੜ੍ਹਾਈ ਜਾਂਦੇ ਨੇ ਅਤੇ ਮੈਂ ਮੈਂ ਤਾਂ ਆਪਣੀ ਗੁੜੀਆ ਵੀ ਸਗੋਂ ਲਾਉਣ ਲੱਗਿਆ ਸੀ ਪਰ ਮੈਂ ਹੁਣ ਸੋਚਿਆ ਹੁਣ ਨਹੀਂ ਲਾਉਣੀ ਹੈਗੀ ਉੱਥੇ ਹੁਣ ਮੈਂ ਸੋਚਿਆ ਕਿ ਤੁਹਾਨੂੰ ਵਧੀਆ ਕਿਸੇ ਹੋਰ ਸਕੂਲ ਦੇਖੀਏ ਆਪਾਂ ਤਾਂ ਇੱਕ ਮੈਂ ਇੱਕ ਸੀਗਾ ਮੈਂ ਦੇਖਿਆ ਦੇਖੋ ਜੀ ਦੇਖੋ ਹਾਂਜੀ ਡੀ ਪੀ ਐਸ ਸਕੂਲ ਹੈਗਾ ਵਧੀਆ ਮੈਂ ਨਹੀਂ ਕਹਿੰਦਾ ਮਾੜਾ ਡੀ ਪੀ ਐਸ ਦੇਖੋ ਗੱਲਬਾਤ ਇੰਨੀ ਨਹੀਂ ਜਿੰਨਾ ਉਹ ਪੈਸਾ ਲੈਂਦੇ ਆ ਮੈਂ ਦੇਖਿਆ ਕਦੇ ਪੁੱਛਿਆ ਮੈਂ ਕਦੇ ਘੱਟੋ ਘੱਟ ਦਸ ਤੋਂ ਬਾਰ੍ਹਾਂ ਹਜ਼ਾਰ ਉਹਨਾਂ ਦੀ ਫੀਸ ਆ ਗੱਲਬਾਤ ਉਹ ਹੈ ਨਹੀਂ ਨਾ ਉਹ ਕੁਆਲਿਟੀ ਦੇ ਰਹੇ ਨੇ ਉਹ ਨਾ ਮਜ਼ਾ ਮਤਲਬ ਬੱਚਿਆਂ ਨੂੰ ਮੈਂ ਦੇਖਿਆ ਆ ਰਿਹਾ ਪੜ੍ਹ ਕੇ ਹਾਂ ਬਸ ਨਾਮ ਦੀ ਆ ਉਹ ਤਾਂ ਹੈ ਹੀ ਹੈ ਅਤੇ ਬਹੁਤ ਸਕੂਨ ਆ ਇੱਕ ਮੈਂ ਦੇਖਿਆ ਸੀਗਾ ਹੋਰ ਡੈਲੀ ਪਤਾ ਨਹੀਂ ਕਿਹੜਾ ਵਰਲਡ ਸਕੂਲ ਹੈ ਉਹ ਵੀ ਪਰ ਉਹ ਵੀ ਆਹੀ ਹਰਕਤ ਉਹਦੀ ਵੀ ਆਹੀ ਸੇਮ ਹੀ ਆ ਦਿੱਲੀ ਵਾਲੇ ਸਕੂਲ ਜਿੰਨੇ ਵੀ ਸਾਰਿਆਂ 'ਚ ਸ਼ੋਸ਼ੇਬਾਜ਼ੀ ਹੈ ਕਹਿੰਦੇ ਉਸ 'ਚ ਵੀ ਇੱਕ ਸਕੂਲ ਹੋਰ ਹੈਗਾ ਆਪਣੇ ਇੱਥੇ ਬੀ ਸੀ ਐਮ ਹੈਗਾ ਮਾਡਲ ਟਾਊਨ ਇਸ਼ਮੀਤ ਚੌਂਕ 'ਚ ਹਾਂ ਉਹ ਤਾਂ ਹਾਂਜੀ ਹਾਂਜੀ ਉਹਨੂੰ ਕਾਫੀ ਦੇਰ ਹੋ ਗਈ ਚਾਲੀ ਪੰਜਤਾਲੀ ਸਾਲ ਹੋ ਗਏ ਸਕੂਲ ਨੂੰ ਬਣੇ ਨੂੰ ਅਤੇ ਨਾਲੇ ਬਹੁਤ ਫੀਸ ਬਹੁਤ ਜੈਨੂਨ ਹੈ ਮੇਰੀ ਗੁੜੀਆ ਮੈਂ ਉੱਥੇ ਹੀ ਲਾਉਣੀ ਹੈ ਦੇਖਿਓ ਵਧੀਆ ਸਕੂਲ ਹੈ ਅਤੇ ਵਧੀਆ ਉਹਨਾਂ ਨੇ ਵਧੀਆ ਰੈਂਕ ਆਉਂਦਾ ਪਿਆ ਸਕੂਲ ਨੰਬਰ ਵਨ ਸਕੂਲ ਆਪਣੇ ਪੰਜਾਬ ਦੇ ਇੱਥੇ ਦਾ ਬਾਕੀ ਮੈਂ ਦੇਖਿਆ ਉੱਥੇ ਕਾਫੀ ਉੱਥੇ ਕਹਿੰਦੇ ਉਹ ਵੀ ਬਣੇ ਹੋਏ ਨੇ ਸਵਿਮਿੰਗ ਪੂਲ ਵਿੱਚ ਹੀ ਹੈਗਾ ਵਿੱਚ ਉਹਨਾਂ ਨੇ ਬੱਚਿਆਂ ਨੂੰ ਰੋਜ਼ ਸਪੋਰਟਸ ਵੀ ਕਰਵਾਂਦੇ ਨੇ ਕਾਫੀ ਕੁਝ ਆ ਵਿੱਚ ਉਹਦੇ ਨਾਲੇ ਫੀਸ ਬੜੀ ਜੈਨੂਨ ਆ ਬੰਦੇ ਕਹੇ ਨਾ ਹਾਂਜੀ ਹਾਂਜੀ ਫੀਸ ਜ਼ਿਆਦਾ ਹੋਵੇ ਤਾਂ ਬੰਦਾ ਗੱਲਬਾਤ ਵੀ ਹੋਵੇ ਵੀ ਫੀਸ ਜ਼ਿਆਦਾ ਹੋਣ ਗੱਲਬਾਤ ਹੋਵੇ ਸਕੂਲ 'ਚ ਉਹ ਵੀ ਨਹੀਂ ਹੁੰਦੀ ਹਾਂ ਇਹਨਾਂ ਦੀ ਪ੍ਰਿੰਸਪਲ ਮੈਨੂੰ ਜਾਣਦੀ ਹੈਗੀ ਆ ਬਹੁਤ ਵਧੀਆ ਬਹੁਤ ਨਾਈਸ ਲੇਡੀ ਆ ਉਹ ਮਤਲਬ ਅ ਹਾਂ ਆ ਬਸ ਆਪਣੇ ਫਰਵਰੀ ਤੋਂ ਸ਼ੁਰੂ ਹੋ ਜਾਣੇ ਆ ਫਾਰਮ ਨਿਕਲ ਜਾਣੇ ਆ ਫਾਰਮ ਭਰਨਾ ਫਿਰ ਉਸ ਤੋਂ ਬਾਅਦ ਫਾਰਮ 'ਤੇ ਨਾਮ ਨਿਕਲੂਗਾ ਲਿਸਟ 'ਚ ਆਪਣੀ ਫਿਰ ਆਪਾਂ ਦਸਦਾਂ ਮੈਂ ਤੁਹਾਨੂੰ ਅੱਜ ਕੱਲ੍ਹ ਨਾ ਨਵਾਂ ਸਿਸਟਮ ਚਲਦਾ ਪਿਆ ਇਹਨਾਂ ਦਾ ਇੱਥੇ ਵੈਸੇ ਉਹ ਇੱਕ ਨਵਾਂ ਆਧਾਰ ਕਾਰਡ ਦਾ ਨਵਾਂ ਆਇਆ ਆਈ ਬੀ ਐਮ ਆਧਾਰ ਕਾਰਡ ਉਹ ਦੇਣਾ ਪੈਂਦਾ ਵਾ ਅਪਾਰ ਆਈ ਡੀ ਦੇਣੀ ਪੈਂਦੀ ਆਪਣੀ ਠੀਕ ਹੈ ਤੁਹਾਨੂੰ ਉਹ ਬਣਵਾ ਲਿਓ ਆਪਣੀ ਹਾਂਜੀ ਅਤੇ ਬਾਕੀ ਆਪਾਂ ਬੱਚਿਆਂ ਨੂੰ ਬਰਥ ਸਰਟੀਫਿਕੇਟ ਦੇਣਾ ਵਾ ਬਾਕੀ ਹੋਰ ਕੀ ਹੋ ਗਿਆ ਅਤੇ ਪਹਿਲੇ ਬੱਚਿਆਂ ਦਾ ਆਪਾਂ ਫੋਰਮ ਕਰਾਵਾਂਗੇ ਰਜਿਸਟਰੇਸ਼ਨ ਕਰਾਵਾਂਗੇ ਫਿਰ ਬੱਚਿਆਂ ਦਾ ਨਾਮ ਨਿਕਲੂਗਾ ਲਿਸਟ 'ਚ ਫਿਰ ਉਸ ਤੋਂ ਬਾਅਦ ਆਪਾਂ ਬੱਚੇ ਨੂੰ ਟੈਸਟ ਹੋਊਗਾ ਇੰਟਰਵਿਊ ਵੀ ਲੈਣਗੇ ਤੁਹਾਡਾ ਵੀ ਲੈਣਗੇ ਫਿਰ ਦੇਖਦੇ ਬੱਚੇ

ਹਾਂਜੀ ਹਾਂਜੀ ਉਹ ਤਾਂ ਹੋ ਜਾਊਗਾ ਬਾਕੀ ਦੇਖਦੇ ਹਾਂ ਪਰ ਥੋੜ੍ਹਾ ਬਾਕੀ ਮੇਰੀ ਗੱਲਬਾਤ ਪਛਾਣ ਹੈਗੀ ਆ ਆਪਣੀ ਜਾਣ ਪਛਾਣ ਹੈਗੀ ਆ ਮੈਂ ਕਰਾ ਦੂੰਗਾ ਐਡਮੀਸ਼ਨ ਕੋਈ ਨਾ ਟੈਂਸ਼ਨ ਨਾ ਲਓ ਤੁਸੀਂ

ਚਲੋ ਕੋਈ ਨੀ ਬਸ ਵਧੀਆ ਵਧੀਆ ਚਲੋ ਠੀਕ ਹੈ ਜੀ ਓਕੇ ਜੀ ਓਕੇ ਓਕੇ ਓਕੇ ਜੀ ਓਕੇ ਓਕੇ